ਪੰਜਾਬੀ ਭਾਸ਼ਾ 'ਤੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹੁੰਦੀਆਂ ਹੈ ਨੇ ਜਿਵੇਂ ਪੰਜਾਬੀ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ ਹੈਗੀ ਜ਼ਿਆਦਾਤਰ ਪੰਜਾਬੀ ਬੋਲਣ ਵਾਲਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਨੌਕਰੀਆਂ ਸਮੇਂ ਇੰਗਲਿਸ਼ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਬਾਹਰਲੇ ਮਤਲਬ ਮੁਲਕਾਂ ਵਿੱਚ ਜ਼ਿਆਦਾ ਅੰਗਰੇਜ਼ੀ ਬੋਲਦੇ ਨੇ ਪੰਜਾਬੀ ਨੂੰ ਮਹੱਤਵਤਾ ਨਹੀਂ ਦੇ ਰਹੇ ਹੈਗੇ ਇਸ ਲਈ ਪੰਜਾਬੀ ਨੂੰ ਗਲਤ ਸਮਝ ਰਹੇ ਨੇ ਪੰਜਾਬੀ ਬਾਰੇ ਗਲਤ ਧਾਰਨਾਵਾਂ ਕਰ ਰਹੇ ਨੇ ਪਰ ਪੰਜਾਬੀ ਅਜਿਹੀ ਇੱਕ ਅਜਿਹੀ ਵੀ ਭਾਸ਼ਾ ਹੈ ਮਤਲਬ ਜਿਸਨੂੰ ਹਰ ਕੋਈ ਸਿੱਖ ਸਕਦਾ ਹੈ ਹਰ ਕੋਈ ਬੋਲ ਸਕਦਾ ਹੈ ਇਸ ਨੂੰ ਸਮਝਣਾ ਵੀ ਬਹੁਤ ਸੌਖਾ ਹੈ ਪੰਜਾਬੀ ਭਾਸ਼ਾ ਇੰਨੀ ਜ਼ਿਆਦਾ ਵਧੀਆ ਪਰ ਕੁਝ ਇਸ ਨੂੰ ਗਲਤ ਧਾਰਨਾਵਾਂ ਦਾ ਮਹੱਤਵ ਦੇ ਰਹੇ ਹਨ ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਸਗੋਂ ਇਸ ਨੂੰ ਧਾਰਨਾ ਇਹਨਾਂ ਗਲਤ ਧਾਰਨਾਵਾਂ ਨੂੰ ਸੁਧਾਰਨਾ ਚਾਹੀਦਾ ਹੈ ਸਾਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਵੀ ਸਾਡੇ ਲਈ ਇੱਕ ਬਹੁਤ ਜ਼ਿਆਦਾ ਮਹੱਤਵ ਭਾਸ਼ਾ ਹੈ ਇਸ ਲਈ ਪੰਜਾਬੀ ਦਾ ਵੀ ਸਾਨੂੰ ਆਦਰ ਸਤਿਕਾਰ ਕਰਨਾ ਚਾਹੀਦਾ ਹੈ